ਇੱਕ ਸੌ ਉਣੱਤੀ ਤੇਰ੍ਹਾਂ ਸੌ ਛਿਆਹਠ ਪੰਦਰ੍ਹਾਂ ਹਜ਼ਾਰ ਤਿੰਨ ਸੌ ਪੰਝੱਤਰ ਅੱਠ ਲੱਖ ਪੱਚੀ ਹਜ਼ਾਰ ਪੰਜ ਸੌ ਸੱਠ ਨੌ ਲੱਖ ਤੇਈ ਹਜ਼ਾਰ ਚਾਰ ਸੌ ਇਕੱਤੀ